ਫੋਟੋ ਖਿੱਚਣਾ ਮੇਰਾ ਬਹੁਤ ਮੁੱਦਾ ਸੌਂਕ ਹੈ ਜਿਸ ਦੇ ਕਾਰਨ ਮੈਨੂੰ ਕੁਝ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੈਂ ਦਰਬਾਰ ਸਾਹਿਬ ਗਿਆ ਹੁੰਦਾ ਹਾਂ ਗੁਰੂ ਘਰ ਦਾ ਨਜ਼ਾਰਾ ਲੈਣ ਵਾਸਤੇ ਮੈਂ ਉਹਨੂੰ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰਨਾ ਚਾਹਿਆ ਕਿ ਉਹ ਕਿਸੇ ਸੇਵਾਦਾਰ ਨੇ ਮੈਨੂੰ ਰੋਕਿਆ ਕਿ ਉਹ ਕਹਿੰਦਾ ਕਿ ਇੱਧਰ ਇਸ ਏਰੀਏ 'ਚ ਫੋਟੋ ਖਿੱਚਣਾ ਮਨ੍ਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੋਈ ਰੀਲ ਜਾਂ ਕੋਈ ਮਨੋਰੰਜਨ ਦਾ ਸਾਧਨ ਨਹੀਂ ਬਣਾ ਰਿਹਾ ਮੈਂ ਇੱਕ ਸ਼ਰਧਾ ਪੂਰਵਕ ਭਾਵਨਾ ਦੇ ਨਾਲ ਗੁਰੂ ਘਰ ਦੀ ਫੋਟੋ ਹੀ ਖਿੱਚਣਾ ਚਾਹੁੰਦਾ ਹਾਂ ਜੋ ਕੀ ਮੇਰਾ ਸ਼ੌਂਕ ਹੈ ਜੋ ਮੈਂ ਇੱਕ ਅੱਛੀ ਹੀ ਕਲਾਕਰਿਤੀ ਨੂੰ ਦੇਖਨ ਵਾਸਤੇ ਕੁਦਰਤ ਦੀ ਨਜ਼ਾਰਿਆਂ ਨੂੰ ਕੈਪਚਰ ਕਰਨਾ ਚਾਹੁੰਦਾ ਹਾਂ ਜੋ ਕਿ ਬਹੁਤ ਅੱਛੀ ਫੋਟੋਆਂ ਵੀ ਖਿੱਚਦਾ ਹਾਂ ਕਦੇ ਕਦੇ ਕਦੇ ਮੈਨੂੰ ਜਿਵੇਂ ਕਿ ਕੋਈ ਕੋਈ ਮਨਿਸਟਰ ਜਾਂ ਕੋਈ ਨੇਤਾ ਆਵੇ ਉਹਦੀ ਵੀ ਮੈਨੂੰ ਫੋਟੋ ਖਿੱਚਣ ਵਾਸਤੇ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਵਾਰ ਉਹਨਾਂ ਦੇ ਸਕਿਉਰਟੀ ਇੰਚਾਰਜ ਉਹ ਕੈਮਰਾ ਖੋਹ ਕੇ ਦਿੱਕਤਾਂ ਦਾ ਮਹਿਸੂਸ ਕਰਵਾਉਂਦੇ ਹਨ ਕਿਉਂਕਿ ਇਸ ਦੇ ਵਿੱਚ ਕਈ ਮੁਸ਼ਕਿਲਾਂ ਵੀ ਆਉਂਦੀਆਂ ਹਨ ਕਿਸੇ ਐਸੀ ਜਗ੍ਹਾ 'ਤੇ ਫੋਟੋ ਖਿੱਚਣੀ ਵੀ ਜ਼ਰੂਰੀ ਹੁੰਦੀ ਹੈ ਕਿ ਕਿੱਥੇ ਕੋਈ ਐਸਾ ਕੋਈ ਕ੍ਰਿਮੀਨਲ ਕਾਂਡ ਹੋ ਰਿਹਾ ਹੋਵੇ ਉਹਦੇ ਲਈ ਵੀ ਥੋੜ੍ਹੇ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਜੋ ਕਿ ਮੈਨੂੰ ਇੱਕ ਫੋਟੋ ਖਿੱਚਣਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਉਹ ਆਪਣਾ ਪ੍ਰੋਫੈਸ਼ਨਲ ਵੀ ਬਣਾਉਣਾ ਚਾਹੁੰਦਾ ਹਾਂ